ਵੀਰ ਜੀ ਜਿੱਥੇ ਤੁਸੀਂ ਖੜ੍ਹੇ ਹੋ ਨਾ ਲਹਿਰੀ ਸ਼ਾਹ ਮੰਦਿਰ ਆ ਇਹ ਜਿਹੜੇ ਪੁਆਇੰਟ 'ਤੇ ਹੈਗੇ ਤਾਂ ਤੁਸੀਂ ਉੱਥੇ ਤੋਂ ਅੱਗੇ ਆਊਂਗੇ ਓਂ ਪੁਰਾਣੇ ਹੋਸਪੀਟਲ ਵਾਲੀ ਸਾਇਡ ਨੂੰ ਅਤੇ ਬੇਲਾ ਚੌਂਕ ਰੋਡ ਨੂੰ ਹੀ ਸਿੱਧਾ ਹੀ ਅੱਗੇ ਤੁਹਾਨੂੰ ਮਿਲੇਗਾ ਅਪੋਲੋ ਹੋਸਪੀਟਲ ਅਪੋਲੋ ਮੈਡੀਕਲ ਸਟੋਰ ਹੈ ਬੇਸਿਕੀਲੀ ਉਹਦੇ ਬਿਲਕੁਲ ਸਾਹਮਣੇ ਡਾਕਟਰ ਸਿਧਾਨਾ ਬੱਚਿਆਂ ਦਾ ਅਤੇ ਉਹਦੇ ਨਾਲ ਕੰਪਿਊਟਰ ਵਰਲਡ ਦੀ ਸ਼ੋਪ ਐਡ ਜੁਆਇੰਨ ਬਿਲਕੁਲ ਨਾਲ ਮਾਰਕਿੰਟ ਦੇ ਵਿੱਚ ਉੱਥੇ ਰਾਈਟ ਨਾ ਸਾਇਡ ਨੂੰ ਅੰਦਰ ਨੂੰ ਸੜ੍ਹਕ ਐਂਟਰ ਕਰਦੀ ਹੈ ਅਤੇ ਨਾਲ ਹੈ ਏ ਟੀ ਐਮ ਵੀ ਹੈਗਾ ਬੈਂਕ ਆਫ ਬੜੌਦਾ ਦਾ ਉਹ ਮਾਰਕਿਟ 'ਚ ਐਂਟਰ ਕਰ ਜਾਇਓ ਅੰਦਰ ਗੁਰਜੀਤ ਇਲੈਕਟ੍ਰਾਨਿਕਸ ਤੁਹਾਨੂੰ ਸ਼ੌਪ ਮਿਲ ਜਾਣੀ ਅੰਦਰਲੇ ਪਾਸੇ